ਮੈਂ ਕਿਸੇ ਸਪੈਸ਼ਲ ਮੌ ਨਾਚ ਤਾਂ ਨਹੀਂ ਕੀਤਾ ਪਰ ਅਸੀਂ ਘਰ ਵਿੱਚ ਸਮਾਗਮ ਦੇ ਮੌਕੇ ਤੇ ਨਾਚ ਕੀਤਾ ਹੈ ਅਸੀਂ ਗੁਆਂਢਣਾਂ ਨਾਲ ਮਿਲ ਕੇ ਪੰਜਾਬ ਦਾ ਪ੍ਰਸਿੱਧ ਲੋਕ ਨਾਚ ਗਿੱਧਾ ਪਾਉਂਦੇ ਹਾਂ ਮੈਨੂੰ ਗਿੱਧਾ ਪਾਉਣਾ ਬਹੁਤ ਪਸੰਦ ਹੈ ਵਿਆਹ ਦੇ ਸਮੇਂ ਤਾਂ ਅਸੀਂ ਗਿੱਧਾ ਮੇਰਾ ਸਭ ਤੋਂ ਯਾਦਗਾਰੀ ਪ੍ਰਦਰਸ਼ਨੀ ਹੈ